ਪਿਛਲੇ ਕੁਛ ਦਹਾਕਿਆਂ ਦੌਰਾਨ ਭਾਰਤ ਵਿੱਚ ਕੁਛ ਨਵੀਆਂ ਨੌਕਰੀਆਂ ਅਤੇ ਭੂਮਿਕਾਵਾਂ ਹਨ ਜਿਵੇਂ ਉਦਾਹਰਨ ਲਈ ਯੂਟੀਊਬਰ ਸਮਾਗ ਦੀ ਨਿਰਮਤਾ ਯਾਤਰੀ ਕੋਮੇਡੀਅਨ ਅਤੇ ਆਦਿ ਭਾਰਤ ਵਿੱਚ ਨੌਜਵਾਨ ਪੀੜ੍ਹੀ ਅੱਜ ਕੱਲ੍ਹ ਯੂਟੀਊਬ ਬਹੁਤ ਆਕਰਸ਼ਿਤ ਹੋਈ ਪਈ ਹੈ ਕਿਉਂਕਿ ਯੂਟੀਊਬਰ ਯੂਟੀਊਬ ਵਿੱਚ ਤੁਸੀਂ ਕੁਛ ਵੀ ਦੇਖ ਸਕਦੇ ਹੋ ਜਿਵੇਂ ਕਿ ਅਗਰ ਕੋਈ ਸਟੂਡੈਂਟ ਹੈ ਉਸਨੂੰ ਆਪਣੀ ਪੜ੍ਹਾਈ ਕਰਨੀ ਹੈ ਉਹਦੇ ਕੋਲ ਪੈਸੇ ਨਹੀਂ ਹੈਗੇ ਹੈ ਉਹ ਯੂਟੀਊਬ ਵਿੱਚ ਜਾ ਕੇ ਆਪਣੀ ਪੜ੍ਹਾਈ ਕਰ ਸਕਦਾ ਹੈ ਅਤੇ ਆਪਣੇ ਆਪ ਨੂੰ ਹੋਰ ਬਿਹਤਰ ਬਣਾ ਸਕਦਾ ਹੈ ਅਤੇ ਅਗਰ ਮੰਨ ਲਓ ਤੁਸੀਂ ਕੋਈ ਵਰਕਰ ਹੋ ਅਤੇ ਤੁਸੀਂ ਆਪਣੀ ਆਪਣੀ ਤਨਖਾਹ ਵਧਾਉਣਾ ਚਾਹੁੰਦੇ ਹੋ ਤਾਂ ਕਰਕੇ ਤੁਸੀਂ ਯੂਟੀਊਬ 'ਤੇ ਜਾ ਸਕਦੇ ਹੋ ਤੁਸੀਂ ਯੂਟੀਊਬਰ ਬਣ ਸਕਦੇ ਹੋ ਯੂਟੀਊਬਰ ਜਿਹੜੇ ਲੋਕ ਹੁੰਦੇ ਆ ਉਹ ਬਹੁਤ ਹੀ ਪੈਸੇ ਕਮਾਉਂਦੇ ਹਨ ਉਹਨਾਂ ਦੇ ਜਿੰਨਾ ਹੀ ਜਿੰਨੇ ਹੀ ਕੰਟੈਂਟ ਪਾਉਂਦੇ ਆ ਉਹਨੂੰ ਸਭ ਯੂਟੀਊਬ 'ਤੇ ਮਿਲ ਜਾਂਦਾ ਹੈ ਆ ਤੁਸੀਂ ਆਪਣੀ ਅਗਰ ਸਕਿੱਲਸ ਵਧਾਉਣੀ ਹੈ ਤੁਸੀਂ ਯੂਟੀਊਬ ਤੇ ਜਾ ਸਕਦੇ ਹੋ ਤੁਸੀਂ ਵੀਡੀਓ ਦੇਖ ਕੇ ਆਪਣੀ ਸਕਿਲਸ ਵਧਾ ਸਕਦੇ ਹੋ ਅਤੇ ਜਿਸ ਨੇ ਵੀਡੀਓ ਪਾਈ ਹੋਵੇਗੀ ਉਸ ਨੂੰ ਪੈਸੇ ਮਿਲਦੇ ਜਾਂਦੇ ਹਨ ਅਤੇ ਜਿਵੇਂ ਗੱਲ ਕਰੀਏ ਕੋਮੇਡੀਅਨ ਦੀ ਅੱਜ ਕੱਲ੍ਹ ਦੀ ਜ਼ਿੰਦਗੀ ਵਿੱਚ ਡਿਪ੍ਰੈਸ਼ਨ ਬਹੁਤ ਵੱਡੀ ਚੀਜ਼ ਹੈ ਜਿਹੜਾ ਦੇਖੋ ਡਿਪਰੈਸ਼ਨ ਵਿੱਚ ਹੀ ਤੁਹਾਨੂੰ ਮਿਲਦਾ ਹੈ ਅਤੇ ਕੋਮੇਡੀਅਨ ਉਹਨਾਂ ਦੇ ਲਈ ਹੀ ਬਣਿਆ ਹੋਇਆ ਹੈ ਕੋਮੇਡੀਅਨ ਅਸਲ ਵਿੱਚ ਆਪਣੀ ਕਲਾ ਨੂੰ ਇਸ ਤਰ੍ਹਾਂ ਰੱਖਦਾ ਹੈ ਕਿ ਦੇਖਣ ਵਾਲਾ ਹੱਸ ਪਵੇ ਅਤੇ ਉਹ ਆਪਣੀ ਗੱਲ ਨੂੰ ਰਿਲੇਟ ਕਰ ਪਾਵੇ ਅਤੇ ਉਸ ਨੂੰ ਬਹੁਤ ਕੁਛ ਸਮਝ ਆਵੇ ਉਹ ਆਪਣੀ ਡਿਪਰੈਸ਼ਨਸ ਤੋਂ ਦੂਰ ਹੋ ਜਾਵੇ ਤਾਂ ਕਰਕੇ ਕੋਮੇਡੀਅਨ ਦੀ ਵੀ ਜ਼ਰੂਰਤ ਆਪਣੇ ਦੇਸ਼ ਨੂੰ ਬਹੁਤ ਜ਼ਿਆਦਾ ਹੈ ਲੋਕ ਬਹੁਤ ਵਧੀਆ ਵਧੀਆ ਕੋਮੇਡੀ ਕਰਦੇ ਹਨ ਇਸਦੇ ਨੋਬਲ ਪ੍ਰਾਈਜ਼ ਮਿਲਦੇ ਹਨ ਅਤੇ ਬਹੁਤ ਕੁਛ ਹੁੰਦਾ ਹੈ ਧੰਨਵਾਦ